ਟੈਕਨੋਲਜੀ ਦੀ ਵਰਤੋਂ ਨੇ ਸਾਡੇ ਸੰਸਾਰ ਦੇ ਆਲੇ ਦੁਆਲੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਚਾਹੇ ਜੋ ਮਰਜ਼ੀ ਖੇਤਰ ਹੋਵੇ ਗੱਲਬਾਤ ਦੇ ਖੇਤਰ ਵਿੱਚ ਕਾਰੋਬਾਰ ਦੇ ਖੇਤਰ ਵਿੱਚ ਇਸ ਕਰਕੇ ਅਸੀਂ ਟੈਕਨੋਲੋਜੀ ਨੂੰ ਕਹਿ ਸਕਦੇ ਹਾਂ ਉਹ ਵੀ ਸਾਡੇ ਲਈ ਇੱਕ ਵਰਦਾਨ ਹੈ ਪਰ ਇਸ ਦੇ ਨਾਲ ਨਾਲ ਇਸਦੇ ਬਹੁਤ ਜ਼ਿਆਦਾ ਨਕਾਰਾਤਮਕ ਰਾਹ ਵੀ ਨਹੀਂ ਕਿਉਂਕਿ ਅਸੀਂ ਇਹ ਕਹਿ ਸਕਦੇ ਹਾਂ ਵੀ ਜਿੱਥੇ ਟੈਕਨੋਲੋਜੀ ਨੇ ਸਾਨੂੰ ਅਗਾਂਹ ਵਧੂ ਸੋਚ ਦਿੱਤੀ ਉਹਦੇ ਨਾਲ ਨਾਲ ਅਸੀਂ ਆਪਣੇ ਰਿਸ਼ਤੇ ਨਾਤਿਆਂ ਨੂੰ ਵੀ ਪਿੱਛੇ ਛੱਡਿਆ ਹੈ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਲੋਕ ਸ਼ੋਸ਼ਲ ਮੀਡੀਆ ਨਹੀਂ ਚਲਾਉਂਦੇ ਸਨ ਉਹ ਇੱਕ ਦੂਜੇ ਨਾਲ ਮਿਲਦੇ ਜੁਲਦੇ ਗੱਲਾਂ ਕਰਦੇ ਪਿਆਰ ਮੁਹੱਬਤ ਸੀ ਪਰ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਹੋਣ ਦੇ ਕਾਰਨ ਕੀ ਹੈ ਕਿ ਲੋਕ ਆਪਣੀਆਂ ਗੱਲਾਂ ਬਾਤਾਂ ਆਪਣੇ ਕਾਰੋਬਾਰ ਫੋਨਾਂ 'ਤੇ ਹੀ ਹੱਲ ਕਰਦੇ ਨੇ ਸਾਰੇ ਮਸਲਿਆਂ ਨੂੰ ਫੋਨਾਂ 'ਤੇ ਹੀ ਹੱਲ ਕਰਨਾ ਚਾਹੁੰਦੇ ਨੇ ਰਲ ਮਿਲ ਕੇ ਬੈਠਣਾ ਗੱਲਾਂ ਕਰਨਾ ਉਹਨਾਂ ਦੇ ਸੁਭਾਵਾਂ ਵਿੱਚੋਂ ਹੀ ਖ਼ਤਮ ਹੁੰਦਾ ਜਾਂਦਾ ਹੈ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਜੋ ਟੈਕਨੋਲੋਜੀ ਹੈ ਉਹਦੇ ਸਾਨੂੰ ਬਹੁਤ ਸਾਰੇ ਲਾਭ ਨੇ ਪਰ ਉਹਦੇ ਨਾਲ ਨਾਲ ਸਾਡੇ ਨੁਕਸਾਨ ਵੀ ਬਹੁਤ ਹੋਏ ਨੇ ਕਿਉਂਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਟੈਕਨੋਲਜੀ 'ਤੇ ਹੀ ਡਿਪੈਂਡ ਹੋ ਜਾਣਗੀਆਂ ਆਪਣੀ ਮੈਮਰੀ ਤਾਂ ਲੱਗਦਾ ਜਿਵੇਂ ਖ਼ਤਮ ਹੀ ਹੋ ਜਾਵੇਗੀ ਜੇਕਰ ਇਹ ਸ਼ੋਸ਼ਲ ਮੀਡੀਆ ਦੇ ਆਪਾਂ ਨੂੰ ਬਹੁਤ ਜ਼ਿਆਦਾ ਲਾਭ ਨੇ ਉਹਦੇ ਨਾਲ ਨਾਲ ਆਪਾਂ ਨੂੰ ਨੁਕਸਾਨ ਵੀ ਨੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਟੈਕਨੋਲੋਜੀ ਦੇ ਨਾਲ ਲੋਕਾਂ ਦੀ ਗੱਲ ਕਰਨ ਦੇ ਵਿੱਚ ਫਰਕ ਪੈਂਦਾ ਲੋਕਾਂ ਦੇ ਬਿਜ਼ਨਸਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਪਰੰਤੂ ਸਾਨੂੰ ਇਹ ਵੀ ਫਿਕਰ ਕਰਨ ਦੀ ਲੋੜ ਹੈ ਕਿ ਜਿਹੜੀ ਟੈਕਨੋਲੋਜੀ ਆ ਉਹਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਸੀ ਪਿਆਰ ਮੁਹੱਬਤ ਅਤੇ ਰਿਸ਼ਤਿਆਂ ਨੂੰ ਖ਼ਤਮ ਕਰਨ ਦੀ ਤਦਾਰ ਤੱਕ ਲੈ ਆਂਦਾ ਹੈ